ਮਾਰਸ਼ਲ ਆਰਟਸ ਮਾਰਸ਼ਲ ਆਰਟਸ ਨੇ ਸਾਡੇ ਇਕਾਗਰਤਾ ਦੇ ਪੱਧਰ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਅਤੇ ਇਸ ਦੀ ਪੜ੍ਹਾਈ ਵੀ ਬਹੁਤ ਵਧੀਆ ਤਰੀਕੇ ਨਾਲ ਕਰਾਈ ਜਾਂਦੀ ਹੈ ਮਾਰਸ਼ਲ ਆਰਟਸ ਕੁੜੀਆਂ ਲਈ ਤਾਂ ਬਹੁਤ ਹੀ ਜ਼ਿਆਦਾ ਵਧੀਆ ਸਿੱਧ ਸਾਬਿਤ ਹੋਇਆ ਹੈ ਕੁੜੀਆਂ ਇਸ ਨੂੰ ਆਪਣੀ ਆਤਮ ਰਕਸ਼ਾ ਲਈ ਵਰਤਦੀਆਂ ਹਨ ਅਤੇ ਆਤਮ ਰਕਸ਼ਾ ਲਈ ਵਰਤਦੀਆਂ ਵਰਤਿਆ ਜਾਂਦਾ ਹੈ ਜਿੱਥੇ ਇਸ ਨੂੰ ਸਕੂਲਾਂ ਕਾਲਜਾਂ ਵਿੱਚ ਪੜ੍ਹਾਇਆ ਜਾਂਦਾ ਹੈ ਉਸੇ ਤਰ੍ਹਾਂ ਹੀ ਇਸ ਇਹਨਾਂ ਨੂੰ ਆਮ ਕੁੜੀਆਂ ਨੂੰ ਵੀ ਸਿਖਾਇਆ ਜਾਂਦਾ ਹੈ ਜੋ ਮਾਰਸ਼ਲ ਆਰਟਸ ਨੇ ਸਾਡੇ ਇਕਾਗਰਤਾ ਦੇ ਪੱਧਰ ਨੂੰ ਬਹੁਤ ਚੰਗੀ ਤਰ੍ਹਾਂ ਸੁਧਾਰਿਆ ਹੈ